ਹੈਲੋ ਮੇਰਾ ਨਾਮ ਜੱਗਪ੍ਰੀਤ ਸਿੰਘ ਹੈ ਮੈਂ ਅੱਜ ਰੀਤੀ ਰਿਵਾਜਾਂ ਬਾਰੇ ਬੋਲਣਾ ਚਾਹੁੰਦਾ ਹਾਂ ਅਤੇ ਜਿਵੇਂ ਕਿ ਪੈੱਨ ਨਾਲ ਕਾਗਜ਼ 'ਤੇ ਲੇਖ ਲਿਖਣਾ ਜਾਂ ਕੋਈ ਕਹਾਣੀ ਲਿਖਣੀ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਜਿਵੇਂ ਕਿ ਮੈਂ ਕਿਤੇ ਵੀ ਜਾਂਦਾ ਹਾਂ ਮੈਨੂੰ ਕੋਈ ਵੀ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹਨ ਅਤੇ ਮੈਂ ਉਹਨਾਂ ਨੂੰ ਪੇਜ ਦੇ ਉੱਤੇ ਲਿ ਡਾਇਰੀ ਦੇ ਉੱਤੇ ਨੋਟ ਕਰ ਲੈਂਦਾ ਹਾਂ ਅਤੇ ਮੈਂ ਪਿੱਛੋਂ ਪੜ੍ਹਦਾ ਹਾਂ ਅਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਅਤੇ ਜਾਂ ਮੈਂ ਆਪਣੇ ਦੋਸਤ ਮਿੱਤਰਾਂ ਨੂੰ ਵੀ ਸਿੱਖਿਆ ਦਿੰਦਾ ਐਂ ਵੀ ਤੁਸੀਂ ਲਿਖਿਆ ਕਰੋ ਲਿਖਣ ਦੇ ਨਾਲ ਸਾਨੂੰ ਬਹੁਤ ਹੀ ਫਾਇਦਾ ਹੁੰਦਾ ਹੈ ਕਿਉਂਕਿ ਅਸੀਂ ਅਗਾਂਹ ਵੀ ਦੱਸ ਸਕਦੇ ਹਾਂ ਵੀ ਅਸੀਂ ਇੱਥੇ ਇੱਥੇ ਘੁੰਮੇ ਹਾਂ ਅਤੇ ਸਾ ਅਸੀਂ ਲੇਖ ਲਿਖੇ ਹਨ ਆਪਣੀ ਜ਼ਿੰਦਗੀ 'ਤੇ ਕਹਾਣੀ ਲਿਖੀ ਹੈ ਅਤੇ ਸਾਨੂੰ ਆਪਣੀ ਚੰਗੀ ਰਾਇਟਿੰਗ ਦੇ ਵਿੱਚ ਲਿਖਣਾ ਚਾਹੀਦਾ ਹੈ ਵੀ ਸਾਫ ਸੁਥਰੀ ਰਾਇਟਿੰਗ ਦੇ ਵਿੱਚ ਲਿਖਣਾ ਲਿਖਣਾ ਚਾਹੀਦਾ ਹੈ ਜਿਸ ਜਿਸ ਨਾਲ ਪੜ੍ਹਨਾ ਬਹੁਤ ਹੀ ਸੌਖਾ ਹੋ ਜਾਂਦਾ ਹੈ ਲਿਖਾਈ ਸੁੰਦਰ ਦੇ ਨਾਲ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਅਤੇ ਸਾਨੂੰ ਇਸ ਚੀਜ਼ ਇਸ ਟੋਪਿਕ 'ਤੇ ਆਪਣੀ ਇੱਕ ਡਾਇਰੀ ਰੱਖਣੀ ਚਾਹੀਦੀ ਹੈ ਜਿੱਥੇ ਵੀ ਸਾਨੂੰ ਕੋਈ ਵੀ ਗੱਲ ਵਧੀਆ ਲੱਗੇ ਅਤੇ ਸਾਨੂੰ ਉਹ ਲਿਖ ਕੇ ਰੱਖ ਲੈਣੀ ਚਾਹੀਦੀ ਹੈ ਅਤੇ ਉਹ ਸਾਡੀ ਕਦੋਂ ਵੀ ਮਾੜੇ ਸਮੇਂ ਦੇ ਵਿੱਚ ਕੰਮ ਆ ਸਕਦੀ ਹੈ ਧੰਨਵਾਦ